ਹਾਂਜੀ ਕਈ ਤਰ੍ਹਾਂ ਦੀਆ ਵੈਬਸਾਈਟ ਜਿਹੜੀ ਆ ਕਿ ਬਣ ਜਾਂਦੀਆਂ ਹਨ ਜੋ ਗਲਤ ਤਰੀਕੇ ਨਾਲ ਬਣਾਈਆ ਜਾਂਦੀਆਂ ਨੇ ਉਹ ਸਿੱਧੇ ਸਾਧੇ ਕਈ ਵਾਰ ਹੋ ਜਾਂਦਾ ਵੀ ਪੜ੍ਹੇ ਲਿਖੇ ਲੋਕਾਂ ਦੇ ਨਾਲ ਵੀ ਠੱਗੀਆਂ ਵੱਜ ਜਾਂਦੀਆਂ ਨੇ ਆਨਲਾਈਨ ਸਿਸਟਮ ਦੇ ਵਿੱਚ ਹੋ ਸਕਦਾ ਇੱਦਾਂ ਠੀਕ ਆ ਫਿਫਟੀ ਪੰਜਾਹ ਪ੍ਰਸੈਂਟ ਇੰਨਾ ਕੁ ਹੈਗਾ ਗਾ ਇਹ ਹੋ ਸਕਦਾ ਗਾ ਅਤੇ ਮੇਰੇ ਨਾਲ ਵੀ ਇੱਕ ਵਾਰ ਹੋਇਆ ਹੈਗਾ ਗਾ ਆਨਲਾਈਨ ਸਿਸਟਮ ਸੀਗਾ ਸੇਲਿੰਗ ਦਾ ਤੇਜਸ ਦੇ ਵਿੱਚ ਕਿ ਮੈਂ ਆਪਣਾ ਮਤਲਬ ਕਿ ਵੱਧ ਤੋਂ ਵੱਧ ਲਾਲਚ ਕਰਕੇ ਬਾਰ੍ਹਾਂ ਹਜ਼ਾਰ ਰੁਪਏ ਤੱਕ ਦਾ ਮੈਂ ਆਪਣਾ ਨੁਕਸਾਨ ਕੀਤਾ ਅਤੇ ਮੈਨੂੰ ਮਿਲਿਆ ਕੁਛ ਵੀ ਨਹੀਂ ਹੈਗਾ ਸੋ ਇਸ ਤਰ੍ਹਾਂ ਤੁਸੀਂ ਵੀ ਸਾਰੇ ਆਨਲਾਈਨ ਠੱਗੀਆਂ ਤੋਂ ਬਚ ਕੇ ਰਹੋ